ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਕਿਰਨਪਾਲ ਹੈ ਮੈਨੂੰ ਮਤਲਬ ਡੰਡਾ ਦੀ ਦੰਦਾਂ ਦੀ ਓਪਮੋ ਅਪਾਰਟਮੈਂਟ ਚਾਹੀਦੀ ਹੈ ਅਤੇ ਮੇਰੇ ਇਸ ਮੇਰੇ ਦੰਦਾਂ ਖ਼ਰਾਬ ਹੋਣ ਕਾਰਨ ਮੈਂ ਆਪਣੇ ਕੰਮ 'ਤੇ ਛੁੱਟੀ ਲੈਤੀ ਹੈ ਅਤੇ ਮੈਂ ਆਪਣੇ ਦੰਦ ਤੁਹਾਨੂੰ ਦਿਖਾਉਣੇ ਹਨ ਇਸ ਲਈ ਮੈਂ ਮਤਲਬ ਤ ਆਪਣੀ ਕੰਮ ਵਾਲੀ ਥਾਂ 'ਤੇ ਨਹੀਂ ਜਾ ਸਕਦੀ ਤੁਹਾਡੇ ਦ ਆਪ ਮੇਰੇ ਦੰਦਾਂ 'ਚ ਦਰਦ ਹੋਣ ਕਰਕੇ ਮੈਂ ਆਪਣੇ ਦੰਦ ਅਪੋਟਮੈਂਟ ਤੁਹਾਡੇ ਤੋਂ ਲੈਣਾ ਚਾਹੁੰਦੀ ਹਾਂ ਅਤੇ ਮੈਨੂੰ ਪਤਾ ਲੱਗਿਆ ਕਿ ਡਾਕਟਰ ਰਾਜਿੰਦਰ ਸ ਗਰੇਵਾਲ ਬਹੁਤ ਹੀ ਇੱਥੋਂ ਦੇ ਮਸ਼ਹੂਰ ਡਾਕਟਰ ਹਨ ਜੋ ਕਿ ਦੰਦਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਾਫ਼ ਸੁਥਰਾ ਬਣਾਈ ਰੱਖਦੇ ਹਨ ਮੈਨੂੰ ਮਤਲਬ ਆਪਣੇ ਦੰਦਾਂ ਦੀ ਸਾਫ਼ ਅ ਸਫਾਈ ਕਰਵਾਉਣੀ ਹੈ ਜੋ ਕਿ ਮੇਰੇ ਦੰਦਾਂ ਵਿੱਚ ਦਰਦ ਹੁੰਦਾ ਹੈ ਇਸ ਲਈ ਮੈਨੂੰ ਅਪੋਇੰਟਮੈਂਟ ਚਾਹੀਦਾ ਮੈਨੂੰ ਉਸਦਾ ਦਿਨ 'ਤੇ ਤਰੀਕ ਵਗੈਰਾ ਡੇਟ ਵਗੈਰਾ ਦੱਸੀ ਜਾਵੇ ਤਾਂ ਕਿ ਮੈਂ ਆਪਣੇ ਦੰਦਾਂ ਦੀ ਅਪੋਟਮੈਂਟ ਲਈ ਤੁਹਾਡੇ ਕੋਲ ਛੇਤੀ ਜਲਦੀ ਤੋਂ ਜਲਦੀ ਤੋ ਆ ਸਕਦੀ ਹਾਂ ਹਾਂ ਅਤੇ ਇਹ ਸ਼ਬਦ ਇਹ ਸਭ 'ਚ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅਤੇ ਮੈਂ ਆਪਣੇ ਦੰਦਾਂ ਤੁਹਾਡੇ ਤੋਂ ਜਲਦੀ ਹੀ ਠੀਕ ਕਰਵਾਉਣ ਆਵਾਂਗੀ ਸਤਿ ਸ਼੍ਰੀ ਅਕਾਲ ਜੀ